ਕੰਮ ਤੋਂ ਬਾਹਰ ਮੇਰੇ ਕਈ ਸ਼ੌਕ ਨੇ ਜਿਵੇਂ ਕਿ ਖੇਡਣਾ ਫਿਲਮਾਂ ਦੇਖਣਾ ਅਤੇ ਆਪਣੇ ਬੱਚਿਆਂ ਨਾਲ਼ ਟਾਈਮ ਸਪੈਂਡ ਕਰਨਾ ਸਾਡਾ ਬਹੁਤ ਜ਼ਿਆਦਾ ਟਾਈਮ ਹੈ ਜਿਹੜਾ ਉਹ ਦਫ਼ਤਰ ਵਿੱਚ ਹੀ ਚਲੇ ਜਾਂਦਾ ਏ ਇਸ ਲਈ ਕੁਛ ਕੁ ਟਾਈਮ ਅਸੀਂ ਮੈਂ ਆਪਣੇ ਬੱਚਿਆਂ ਨਾਲ਼ ਬਿਤਾਉਨਾ ਏ ਤਾਂ ਜੋ ਉਹਨਾਂ ਨਾਲ਼ ਸਮਾਂ ਕੱਢਿਆ ਜਾਵੇ ਉਹਨਾਂ ਨੂੰ ਸਹੀ ਗੱਲਾਂ ਸਿਖਾਈਆਂ ਜਾਣ ਅਤੇ ਅਤੇ ਉਹਨਾਂ ਨੂੰ ਖੇਡਣ ਵੱਲ ਉਤ ਉਤਸ਼ਾਹਿਤ ਕਰਿਆ ਜਾਵੇ ਜਿਵੇਂ ਕਿ ਛੁੱਟੀ ਵਾਲੇ ਦਿਨ ਉਹਨਾਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕ ਕਰਵਾਏ ਜਾਂਦੇ ਹੈ ਉਹਨਾਂ ਨੂੰ ਖੇਡਣ ਲਈ ਗਰਾਊਂਡ ਵਿੱਚ ਲੈ ਜਾਨਾ ਹੈ ਤਾਂ ਤਾਂ ਜੋ ਉਹਨਾਂ ਦੀ ਸਿਹਤ ਚੰਗੀ ਰਹੇ ਅਤੇ ਉਹਨਾਂ ਦੀ ਉਹਨਾਂ ਨੂੰ ਸੁਸਾਇਟੀ ਵਿੱਚ ਜਾ ਕੇ ਮਿਲਣ ਗਿਲਣ ਮੇਲ ਜੋਲ ਵੱਧ ਸਕੇ ਹੋਰ ਬੱਚਿਆਂ ਨਾਲ਼ ਖੁੱਲ੍ਹ ਕੇ ਖੇਡ ਸਕਣ